ਸਾਡੇ ਰੂਪਨਗਰ ਵਿੱਚ ਬਹੁਤ ਤਰੀਕੇ ਦੇ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਹੁੰਦੀਆਂ ਹਨ ਜਿਵੇਂ ਕਿ ਇੱਥੇ ਕ੍ਰਿਕੇਟ ਬਹੁਤ ਹੀ ਜ਼ਿਆਦਾ ਖੇਡਿਆ ਜਾਂਦਾ ਹੈ ਇਸ ਤੋਂ ਇਲਾਵਾ ਮਨੋਰੰਜਨ ਲਈ ਆਪਾਂ ਇੱਥੇ ਗਿਟਾਰ ਦਾ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ ਜਿਹਦੇ ਕਰਕੇ ਕਾਫ਼ੀ ਲੋਕੀ ਮਿਲਦੇ ਹਨ